ਸਾਡੇ ਘਰ ਵਿੱਚ ਬੜੇ ਭਰਾ ਨੂੰ ਸੱਪ ਨੇ ਕੱਟ ਲਿਆ ਜਿਸ ਨਾਲ ਕਿ ਕੱਟ ਪੂਰਾ ਦਿਖਾਈ ਦੇ ਰਿਹਾ ਸੀਗਾ ਅਤੇ ਸਾਡੇ ਮਾਂ ਬਾਪ ਨੇ ਕੀ ਕੀਤਾ ਕਿ ਇੱਕ ਚਾਕੂ ਲੈ ਕੇ ਉਸ ਨੂੰ ਕੱਟ ਮਾਰਤਾ ਗਿਆ ਕੱਟ ਮਾਰ ਕੇ ਜਿਹੜਾ ਉਸਕਾ ਉਹਦਾ ਖੂਨ ਸੀਗਾ ਉਹ ਬਾਹਰ ਆ ਗਿਆ ਅਤੇ ਉਸਦੇ ਉੱਪਰਲੇ ਪਾਸੇ ਕੁਛ ਉੱਪਰ ਥਾਂ 'ਤੇ ਇੱਕ ਪੱਟੀ ਬੰਨ੍ਹ ਦਿੱਤੀ ਗਈ ਤਾਂ ਕਿ ਜਿਹੜਾ ਖੂਨ ਵਿੱਚ ਜ਼ਹਿਰ ਨਾ ਮਿਲ ਸਕੇ ਉਸ ਤੋਂ ਬਾਅਦ ਉਹਨੂੰ ਇਹ ਅਸੀਂ ਹਸਪਤਾਲ ਲੈ ਗਏ ਉੱਥੇ ਜਾ ਕੇ ਉਸਦਾ ਟਰੀਟਮੈਂਟ ਚੱਲਿਆ ਕੁਝ ਵਿਅਕਤੀਆਂ ਨੇ ਇਹ ਵੀ ਸਾਨੂੰ ਦੱਸਿਆ ਕਿ ਕਿਸੇ ਬੰਗਾਲੇ ਤੋਂ ਜੋ ਕਿ ਝਾੜ ਝੰਮ ਕਰਦਾ ਸੀਗਾ ਉਸ ਤੋਂ ਦਿਖਾਉ ਤਾਂ ਉਸਨੂੰ ਅਸੀਂ ਬੁਲਾਇਆ ਉਸਨੇ ਆ ਕੇ ਸੱਪ ਦਾ ਮਣਕਾ ਉਸ ਸਥਾਨ 'ਤੇ ਲਗਾਇਆ ਅਤੇ ਉਹ ਮਣਕਾ ਪੂਰਾ ਭਰ ਗਿਆ ਐਨ ਉਸ ਤੋਂ ਮਹਿਸੂਸ ਇਹ ਹੋਇਆ ਕਿ ਜ਼ਹਿਰ ਸ਼ਾਇਦ ਬਾਹਰ ਆ ਗਿਆ ਹੋਵੇ ਬੰਗਾਲੇ ਨੂੰ ਪੁੱਛਿਆ ਗਿਆ ਉਹ ਕਹਿੰਦਾ ਦੋ ਵਾਰੀ ਤਿੰਨ ਵਾਰੀ ਹੋਰ ਮਣਕਾ ਲਗਾਉ ਤੁਹਾਡਾ ਸਾਰਾ ਜ਼ਹਿਰ ਬਾਹਰ ਆ ਜਾਵੇਗਾ